ਹਾਂਜੀ ਖਾਲਸਾ ਕੈਬ ਤੋਂ ਬੋਲਦੇ ਓਂ ਮੈਂ ਨਾ ਘਰ ਤੋਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਸੀ ਉੱਥੇ ਮੈਨੂੰ ਅੱਧਾ ਕੁ ਘੰਟਾ ਲੱਗ ਜਾਣਾ ਉਸ ਤੋਂ ਬਾਅਦ ਜੋਤੀ ਸਰੂਪ ਗੁਰਦੁਆਰਾ ਸਾਹਿਬ ਵੀ ਜਾਣਾ ਉੱਥੇ ਵੀ ਮੱਥਾ ਟੇਕਣਾ ਅਤੇ ਸ਼ਾਇਦ ਅੱਧਾ ਕੁ ਘੰਟਾ ਉੱਥੇ ਵੀ ਲੱਗ ਜੇ ਅਤੇ ਮੈਨੂੰ ਨੌਂ ਕੁ ਵਜੇ ਚਾਹੀਦੇ ਆ ਕੈਬ ਚਾਹੀਦੀ ਆ ਤਾਂ ਕਿ ਮੈਂ ਸਮੇਂ ਸਿਰ ਲੰਚ ਟਾਈਮ ਤੋਂ ਪਹਿਲਾਂ ਪਹਿਲਾਂ ਵਾਪਸ ਮੁੜ ਸਕਾਂ ਅਤੇ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਵੀ ਇਸ ਵਕਤ ਵੀ ਕੈਬ ਉਪਲਬਧ ਹੈ ਜਾਂ ਨਹੀਂ ਮੈਨੂੰ ਸਮਾਂ ਵੀ ਦੱਸਿਆ ਜਾਵੇ ਅਤੇ ਮੈਂ ਵਾਪਸ ਘਰ ਵੀ ਮੁੜਨਾ ਟਾਈਮ ਸਿਰ ਸ਼ਾਇਦ ਦੋ ਤਿੰਨ ਘੰਟੇ ਦਾ ਸਮਾਂ ਲੱਗ ਹੀ ਸਕਦਾ ਥੋੜ੍ਹਾ ਜਿਹਾ ਮੈਨੂੰ ਮਾਰਕੀਟ ਦਾ ਵੀ ਕੰਮ ਹੈ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਵੀ ਉਪਲਬਧ ਹੈ ਜਾਂ ਨਹੀਂ ਹੈ